ਸਭ ਤੋਂ ਵੱਧ ਚੁਣੌਤੀਆਂ ਵਿੱਚੋਂ ਇੱਕ ਰੋਸ਼ਨੀ ਨਾਲ ਨ ਨਜਿੱਠਣਾ ਹੈ ਭਾਵੇਂ ਇਹ ਬਹੁਤ ਜ਼ਿਆਦਾ ਤੇਜ਼ ਧੁੱਪ ਹੋਵੇ ਜਾਂ ਮੱਧਮ ਅੰਦਰੂਨੀ ਸਥਿਤੀਆਂ ਮਾੜੀ ਰੋਸ਼ਨੀ ਫੋਟੋ ਦੀ ਗੁਣਵੱਤਾ ਨੂੰ ਬਹੁਤ ਪ੍ਰਭਾਵਿਤ ਕਰ ਸਕਦੀਆਂ ਹਨ ਇਸ ਨੂੰ ਦੂਰ ਕਰਨ ਲਈ ਫੋਟੋਗ੍ਰਾਫਰ ਅਕਸਰ ਬਾਹਰੀ ਰੋਸ਼ਨੀ ਸਰੋਤਾਂ ਦੀ ਵਰਤੋਂ ਕਰਦੇ ਹਨ ਜਿਵੇਂ ਕਿ ਸਾਫਟ ਬਾਕਸ ਜਾਂ ਰਿਫਲੈਕਟਰ ਜਾਂ ਉਹ ਆਪਣੇ ਕੈਮਰੇ ਸੈਟਿੰਗ ਨੂੰ ਐਡਜਸਟ ਕਰਦੇ ਹੋਏ ਆਈ ਐਸ ਓ ਵਧਾਉਂਦੇ ਹਨ ਜਾਂ ਸ਼ਟਰ ਸਪੀਡ ਨੂੰ ਹੌਲੀ ਹੌਲੀ ਕਰਦੇ ਹਨ ਤਾਂ ਜੋ ਹੋਰ ਰੋਸ਼ਨੀ ਆ ਸਕੇ ਇੱਕ ਹੋਰ ਚੁਣੌਤੀ ਚਲਦੇ ਵਿਸ਼ਿਆਂ ਨੂੰ ਕੈਪਚਰ ਕਰਨਾ ਹੈ ਭਾਵੇਂ ਇਹ ਇੱਕ ਵਿਅਕਤੀ ਜਾਨਵਰ ਜਾਂ ਇੱਥੋਂ ਤੱਕ ਕਿ ਇੱਕ ਚਲਦੀ ਵਸਤੂ ਵੀ ਹੋਵੇ ਬਲਰ ਇੱਕ ਆਮ ਮੁੱਦਾ ਹੈ ਹੱਲ ਅਕਸਰ ਐਕਸ਼ਨ ਨੂੰ ਫਰੀਜ਼ ਕਰਨ ਲਈ ਤੇਜ਼ ਸ਼ਟਰ ਸਪੀਡ ਦੀ ਵਰਤੋਂ ਕਰਨ ਵਿੱਚ ਹੈ ਜਾਂ ਤੇਜ਼ੀ ਲਈ ਕਈ ਫਰੇਮਾਂ ਨੂੰ ਕੈਪਚਰ ਕਰਨ ਲਈ ਬਸ਼ਟ ਮੂਡ ਵਿੱਚ ਸਵਿਚ ਕਰਨਾ ਹੈ ਜਿਸ ਨਾਲ ਸੰਪੂਰਨ ਸ਼ੋਟ

ਸੰਖੇਪ ਵਿੱਚ ਫੋਟੋਗ੍ਰਾਫੀ ਵਿੱਚ ਚੁਣੌਤੀਆਂ ਨੂੰ ਪਾਰ ਕਰਨ ਲਈ ਅਕਸਰ ਤਕਨੀਕੀ ਸਮਾਯੋਜਨ ਧੀਰਜ ਅਤੇ ਰਚਨਾਤਮਕ ਸ਼ਾਮਿਲ ਹੁੰਦੀਆਂ ਹਨ ਹੁਨਰ ਜੋ ਅਭਿਆਸ ਅਤੇ ਤਜਰਬੇ ਨਾਲ ਆਉਂਦਾ ਹੈ